ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਦੁਆਰਾ ਟਾਹਲੀ ਸਾਹਿਬ ਤੋਂ ਪ ਪ੍ਰਧਾਨ ਸਾਹਿਬ ਗੱਲ ਕਰਦੇ ਪਏ ਹਾਂਜੀ ਹਾਂਜੀ ਹਾਂਜੀ ਜਿਹੜੇ ਸਾਡੇ ਗੁਰਦੁਆਰਾ ਟਾਹਲੀ ਸਾਹਿਬ ਹੈ ਇਹ ਪਿੰਡ ਦੇ ਬਾਹਰਲੇ ਪਾਸੇ ਸਥਿਤ ਆ ਅਤੇ ਇੱਥੇ ਪਹਿਲੇ ਸਮਿਆਂ ਦੇ ਵਿੱਚ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਿੰਘ ਜੀ ਉਹ ਆਪਣੇ ਘੋੜੇ ਲੈ ਕੇ ਆਏ ਸੀ ਅਤੇ ਉਹਨਾਂ ਨੇ ਆਪਣੇ ਘੋੜੇ ਜਿਹੜੇ ਹੈ ਨਾ ਉਹ ਟਾਹਲੀ ਨਾਲ ਬੰਨੇ ਸਨ ਅਤੇ ਉਦੋਂ ਤੋਂ ਹੀ ਇਸ ਜਗ੍ਹਾ ਦੀ ਉਹ ਇੱਥੇ ਰੁਕੇ ਵੀ ਸੀ ਵਿਸ਼ਰਾਮ ਕੀਤਾ ਸੀ ਅਤੇ ਉਦੋਂ ਤੋਂ ਹੀ ਇੱਥੇ ਫਿਰ ਮਾਨਤਾ ਸ਼ੁਰੂ ਹੋ ਗਈ ਅਤੇ ਉਸ ਗੱਲ ਤੋਂ ਇੱਥੇ ਨਾਮ ਜਿਹੜਾ ਹੈ ਟਾਹਲੀ ਸਾਹਿਬ ਗੁਰਦੁਆਰਾ ਇਹਨਾਂ ਦਾ ਨਾਮ ਵੀ ਉਸੇ ਗੱਲ ਕਰਕੇ ਰੱਖਿਆ ਹੋਇਆ ਅਤੇ ਅੱਜ ਵੀ ਜਿਹੜੇ ਉਹ ਟਾਹਲੀ ਸਾਹਿਬ ਨੇ ਉਹ ਉਵੇਂ ਦੇ ਉਵੇਂ ਪਏ ਨਾ ਉਹਨਾਂ ਨੂੰ ਘੁਣ ਨਾ ਕੁਛ ਅਤੇ ਉਹ ਐਜ ਇਟ ਜਿੱਦਾਂ ਉਸ ਵੇਲੇ ਸੀਗੇ ਉਦੇ ਤੁਸੀਂ ਹੁਣ ਵੀ ਦਰਸ਼ਨ ਕਰ ਸਕਦੇ

ਹਾਂਜੀ ਬਿਲਕੁਲ ਬਿਲਕੁਲ ਸਾਡੇ ਇੱਥੇ ਚੌਵੀ ਘੰਟੇ ਲੰਗਰ ਹੈ ਤੁਸੀਂ ਆਪਣਾ ਚਾਹ ਪਾਣੀ ਅੰਨ ਪਾਣੀ ਛੱਕ ਸਕਦੇ ਹੋ ਲੰਗਰ ਬੈਠ ਕੇ ਛੱਕ ਸਕਦੇ ਹੋ ਸਾਡੇ ਰਹਿਣ ਦਾ ਵੀ ਪ੍ਰਬੰਧ ਹੈ ਸਾਡੇ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਵੀ ਬਣੇ ਹੋਏ ਹਨ ਵਾਸ਼ਰੂਮ ਬਣੇ ਹਨ ਜਿਸ ਤਰ੍ਹਾਂ ਮਰਜ਼ੀ ਤੁਸੀਂ ਆਪਣਾ ਪਰਿਵਾਰ ਲੈ ਕੇ ਇੱਥੇ ਜਦੋਂ ਮਰਜ਼ੀ ਆ ਜੋ ਹਾਂਜੀ ਮੇਲਾ ਇੱਥੇ ਹਰ ਸਾਲ ਇੱਕ ਵਾਰ ਲੱਗਦਾ ਹੈ ਮੇਲਾ ਵਿਸਾਖੀ ਦੇ ਤਿਉਹਾਰ 'ਤੇ ਲੱਗਦਾ ਹੈ ਚੌਥੇ ਮਹੀਨੇ ਵਿਸਾਖੀ ਜਦੋਂ ਆਉਂਦੀ ਹੈ ਤਾਂ ਉਸ ਵੇਲੇ ਇੱਥੇ ਭਰਵਾਂ ਮੇਲਾ ਲੱਗਦਾ ਜਿੱਥੇ ਆਲੇ ਦੁਆਲੇ ਦੀ ਸਾਧ ਸੰਗਤ ਜਿਹੜੀ ਹੈ ਹੁੰਮ ਹੁੰਮਾ ਕੇ ਇੱਥੇ ਪਹੁੰਚਦੀ ਹੈ ਅਤੇ ਇੱਥੇ ਦਰਸ਼ਨ ਕਰਕੇ ਜਿਹੜੇ ਉਹ ਜਾਂਦੇ ਹਨ

ਹਾਂਜੀ ਹਾਂਜੀ ਹਾਂਜੀ ਤੁਸੀਂ ਬਲਾਚੌਰ ਤੱਕ ਕੰਗਣੇ ਦੇ ਪੁੱਲ ਤੱਕ ਤੁਸੀਂ ਬਾਏ ਬੱਸ ਜਾਂ ਕਿੱਦਾਂ ਵੀ ਤੁਸੀਂ ਪਹੁੰਚਣਾ ਪਹੁੰਚ ਸਕਦੇ ਹੋ ਉੱਥੋਂ ਤੁਸੀਂ ਆਟੋ ਕਰ ਸਕਦੇ ਹੋ ਅਤੇ ਤੁਸੀਂ ਬੜੇ ਸੌਖੇ ਤਰੀਕੇ ਨਾਲ ਤੁਸੀਂ ਕਹਿਣਾ ਕਿ ਅਸੀਂ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਜਾਣਾ ਆ ਅਤੇ ਉਹ ਤੁਹਾਨੂੰ ਇੱਥੇ ਪੁਜਾ ਕੇ ਜਾਉਗੇ

ਮਿਹਰਬਾਨੀ ਮਿਹਰਬਾਨੀ